ਹਾਂਜੀ ਮੈਂ ਬਹੁਤ ਵਾਰ ਪੰਜਾਬੀ ਦਾ ਅਤੇ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ ਜਿਵੇਂ ਕਿ ਮੈਂ ਪੇਸ਼ੇ ਵਜੋਂ ਇੱਕ ਟੀਚਰ ਹਾਂ ਤਾਂ ਮੇਰੇ ਕੋਲ ਬਾਹਰੋਂ ਕਈ ਭਾਸ਼ਾਵਾਂ ਵਾਲੇ ਆਦਮੀ ਆਉਂਦੇ ਰਹਿੰਦੇ ਹਨ ਹੁਣ ਕੁਝ ਕੁ ਦਿਨ ਪਹਿਲਾਂ ਕਨੇਡਾ ਵਿੱਚ ਰਹਿੰਦੇ ਸਾਡੇ ਪਿੰਡ ਦੇ ਇੱਕ ਪਰਿਵਾਰ ਨਾਲ ਪਿੰਡ ਵਿੱਚ ਕੁਝ ਅੰਗਰੇਜ਼ ਆਏ ਸਨ ਅਤੇ ਉਹ ਪਿੰਡ ਦ ਘੁੰਮਣ ਲਈ ਪਿੰਡ ਦੇ ਸਕੂਲ ਵਿੱਚ ਆਏ ਅਤੇ ਸਕੂਲ ਵਿੱਚ ਆਏ ਤਾਂ ਉਹਨਾਂ ਨੇ ਬੱਚਿਆਂ ਨਾਲ ਗੱਲ ਕਰਨੀ ਚਾਹੀ ਪਰ ਨਾ ਉਹਨਾਂ ਦੀ ਗੱਲ ਬੱਚਿਆਂ ਨੂੰ ਸਮਝ ਲੱਗਦੀ ਸੀ ਅਤੇ ਨਾ ਬੱਚਿਆਂ ਨੂੰ ਉਹਨਾਂ ਦੀ ਅਤੇ ਫਿਰ ਮੈਂ ਬ ਅੰਗਰੇਜ਼ਾਂ ਦੁਆਰਾ ਬੋਲੀ ਅੰਗਰੇਜ਼ੀ ਦਾ ਅਨੁਵਾਦ ਕਰਕੇ ਬੱਚਿਆਂ ਨੂੰ ਸਮਝਾਇਆ ਅਤੇ ਬੱਚਿਆਂ ਦੁਆਰਾ ਬੋਲਿਆ ਜਾਣ ਵਾਲਾ ਇੱਕ ਇੱਕ ਲਫਜ਼ ਅੰਗਰੇਜ਼ੀ ਵਿੱਚ ਅੰਗਰੇਜ਼ਾਂ ਨੂੰ ਸਮਝਾਇਆ ਬਾਅਦ ਵਿੱਚ ਮੈਂ ਅੰਗਰੇਜ਼ਾਂ ਨੂੰ ਪਿੰਡ ਬਾਰੇ ਵੀ ਦੱਸਿਆ ਅਤੇ ਪਿੰਡ ਦੇ ਬਜ਼ੁਰਗਾਂ ਨਾਲ ਵੀ ਗੱਲਬਾਤ ਕਰਾਈ ਦੇ ਪਿੰਡ ਦੀ ਹਿਸਟਰੀ ਬਾਰੇ ਵੀ ਉਹਨਾਂ ਨੂੰ ਜਾਣੂ ਕਰਾਇਆ